ਸਾਡੇ ਘਰ ਵੈਸੇ ਤਾਂ ਚਲੋ ਕਿੰਨੇ ਘੰਟੇ ਬਿਜਲੀ ਆਉਂਦੀ ਹੈ ਇਹ ਤਾਂ ਮੈਂ ਪੱਕਾ ਨਹੀਂ ਕਹਿ ਸਕਦੀ ਫਿਰ ਵੀ ਚੌਵੀ ਘੰਟੇ ਤਾਂ ਆਉਂਦੀ ਹੈ ਪਰ ਜਿਸ ਵੇਲੇ ਬਾਰਿਸ਼ ਹੋ ਜਾਂਦੀ ਹੈ ਬਾਰਿਸ਼ ਦੇ ਦੌਰਾਨ ਉਸ ਵੇਲੇ ਬਹੁਤ ਹੀ ਜ਼ਿਆਦਾ ਕੱਟ ਪਤਾ ਨਹੀਂ ਕਿਉਂ ਲਗਾ ਦਿੰਦੇ ਆ ਕਿਉਂ ਤਾਰਾਂ ਦਾ ਇਹਨਾਂ ਦਾ ਨੁਕਸ ਪੈ ਜਾਂਦਾ ਹੈ ਉਹ ਮੈਨੂੰ ਹਾਲੇ ਤੱਕ ਵੀ ਨਹੀਂ ਸਮਝ ਆਇਆ ਅਤੇ ਸਾਡੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਕਈ ਵਾਰੀ ਅਸੀਂ ਪਾਣੀ ਨਹੀਂ ਭਰਿਆ ਹੁੰਦਾ ਕਈ ਵਾਰੀ ਸਾਨੂੰ ਕੀ ਪਤਾ ਹੁੰਦਾ ਕਿ ਬੱਤੀ ਇੰਨੀ ਦੇਰ ਤੱਕ ਜਾਏਗੀ ਅਤੇ ਸਾਡੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੁੰਦੀ ਅਸੀਂ ਕਈ ਕੰਮ ਸੋਚੇ ਹੁੰਦੇ ਕਿ ਇਹ ਛੁੱਟੀ ਵਾਲੇ ਦਿਨ ਕਰਾਂਗੇ ਅਤੇ ਛੁੱਟੀ ਵਾਲੇ ਦਿਨ ਇੱਕ ਤਾਂ ਬਾਰਿਸ਼ ਹੋ ਜਾਂਦੀ ਹੈ ਅਤੇ ਬਾਰਿਸ਼ ਦੇ ਨਾਲ ਬੱਤੀ ਦਾ ਕਨੈਕਸ਼ਨ ਹੈਗਾ ਤਾਰਾਂ ਪਤਾ ਨਹੀਂ ਇੱਥੇ ਕਿਉਂ ਸੜ ਜਾਂਦੀਆਂ ਹੈ ਜਾਂ ਕੀ ਫੋਲਟ ਪੈ ਜਾਂਦਾ ਅਤੇ ਉਹ ਅ ਪਾਣੀ ਬੱਤੀ ਗੁੱਲ ਹੋਏਗੀ ਤਾਂ ਫਿਰ ਕਈ ਕੰਮ ਸਾਡੇ ਰਹਿ ਜਾਂਦੇ ਆ ਜੋ ਅਸੀਂ ਸੋਚਿਆ ਹੁੰਦਾ ਉਹ ਬਿਲਕੁਲ ਨਹੀਂ ਹੁੰਦਾ ਅਤੇ ਇਹ ਪਰ ਗਰਮੀਆਂ 'ਚ ਵੀ ਸਾਨੂੰ ਉਸ ਤਰ੍ਹਾਂ ਹੀ ਇੱਕ ਸੋਮਵਾਰ ਤਾਂ ਇਹਨਾਂ ਨੇ ਕੱਟ ਲਗਾਉਣਾ ਹੀ ਲਗਾਉਣਾ ਹੁੰਦਾ ਉਹ ਪੱਕਾ ਹੀ ਹੁੰਦਾ ਫਿਰ ਵੀ ਵਿੱਚੋਂ ਕੋਈ ਕੱਟ ਲੱਗ ਜਾਵੇ ਅਤੇ ਕੋਈ ਓ ਕੋਈ ਗਰੰਟੀ ਨਹੀਂ ਹੈਗੀ ਕਿ ਕੋਈ ਮੰਡੇ ਦਾ ਹੀ ਕ ਕੱਟ ਲੱਗੇਗਾ ਹੋਰ ਦਿਨਾਂ 'ਚ ਵੀ ਕੱਟ ਲੱਗ ਜਾਂਦਾ ਹੈ ਇਹ ਇਹਨਾਂ ਦੀ ਮਰਜ਼ੀ ਹੈਗੀ ਹੈ ਕਿ ਕਦੋਂ ਕੱਟ ਲਾ ਦੇਣਗੇ ਅਤੇ ਇਸ ਕਰਕੇ ਫਿਰ ਸਾਨੂੰ ਬੜੀ ਮੁਸ਼ਕਿਲ ਆ ਜਾਂਦੀ ਹੈ ਕਈ ਵਾਰੀ ਤਾਂ ਗਰਮੀ ਇੰਨੀ ਹੁੰਦੀ ਹੈ ਅਤੇ ਉਸ ਵੇਲੇ ਇਹ ਕੱਟ ਲਾਉਂਦੇ ਉਸ ਵੇਲੇ ਕੱਟਣਾ ਬੜਾ ਹੀ ਮੁਸ਼ਕਿਲ ਹੁੰਦਾ ਉੱਤੋਂ ਗਰਮੀ ਨੇ ਤੰਗ ਕੀਤਾ ਹੁੰਦਾ ਉਤੋਂ ਇਹ ਬੱਤ ਬੱਤੀ ਵਾਲੇ ਤੰਗ ਕਰਨ ਲੱਗ ਪੈਂਦੇ ਆ ਇਹ ਪੰਜਾਬ 'ਚ ਸਾਡੇ ਬੜੀ ਮੁਸ਼ਕਿਲ ਆਉਂਦੀ ਪਈ ਹੈ ਔਰ ਇਹ ਕਮੀ ਥੋੜ੍ਹੀ ਦੂਰ ਕਰਨੀ ਚਾਹੀਦੀ ਇਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬੱਤੀ ਸਾਡੇ ਕੋਲ ਇੰਨੀ ਕੁ ਸਰਪਲਸ ਹੋਵੇ ਕਿ ਸਾਨੂੰ ਅਸੀਂ ਲੋਕਾਂ ਨੂੰ ਦਿੰਦੇ ਪਏ ਹਾਂ ਪਰ ਆਪ ਵੀ ਤਾਂ ਦੇਖੀਏ ਕਿ ਅਸੀਂ ਆਪ ਤਾਂ ਨਹੀਂ ਤੰਗੀ 'ਚ ਆਉਂਦੇ ਪਏ ਅਤੇ ਇਹ ਸਾਡੀ ਗੌਰਮੈਂਟ ਨੂੰ ਸੋਚਣਾ ਚਾਹੀਦਾ ਹੈ ਕਿ ਹ ਜਿਹੜੀ ਹੈ ਗਰਮੀ ਚ ਵੀ ਕੱਟ ਲੈਂਦੇ ਹੈ ਜੇ ਬਾਰਿਸ਼ ਹੋਈ ਤਾਂ ਕੱਟ ਲਈ ਜੇ ਹਨੇਰੀ ਚੱਲੀ ਤੇ ਤਾਂ ਕੋਈ ਤਾਰਾਂ 'ਚ ਨੁਕਸ ਪੈ ਜਾਂਦਾ ਉਹ ਇਹਨਾਂ ਦੇ ਤਾਰਾਂ ਦੇ ਨੁਕਸ ਮੈਨੂੰ ਨਹੀਂ ਸਮਝ ਆਉਂਦਾ ਕਦੋਂ ਠੀਕ ਹੋਣਗੇ